ਪੰਜਾਬ ਦੇ ਵਿੱਚ ਸੰਗੀਤ ਤਾਂ ਮੇਲਿਆਂ ਤੋਂ ਸ਼ੁਰੂ ਹੁੰਦਾ ਜਦੋਂ ਮੇਲਾ ਸ਼ੁਰੂ ਹੋਣਾ ਤਾਂ ਲੋਕ ਗੀਤ ਸੁਣਨ ਲਈ ਲੋਕ ਇਕੱਠੇ ਹੁੰਦੇ ਹੈ ਔਰ ਮੇਲਿਆਂ ਦੇ ਵਿੱਚ ਲੋਕ ਗਾਇਕ ਜੋੜੀਆਂ ਗੀਤ ਗਾਉਂਦੀਆਂ ਸੀ ਪਰ ਜਦੋਂ ਸਵਰੂਪ ਬਦਲ ਗਿਆ ਅੱਜ ਉਹ ਕ ਵੱਡੇ ਵੱਡੇ ਸਮਾਰੋਹ ਬਣ ਗਏ ਨੇ ਅੱਜ ਵੀ ਉਹ ਸਮਾਰੋਹ ਚਾਹੇ ਸਰਤਾਜ ਦਾ ਹੋਵੇ ਪਨ ਬਠਿੰਡੇ ਦੀ ਗੱਲ ਕਰਦਾ ਬਠਿੰਡੇ ਟੁਲਿੱਪ ਕਲੱਬ ਹੈ ਸਰਤਾਜ ਆਇਆ ਉਹਦਾ ਸ਼ੋ ਬੁੱਕ ਹੋਇਆ ਲਖਵਿੰਦਰ ਵਡਾਲੀ ਦਾ ਸ਼ੋ ਟੁਲਿਪ 'ਚ ਬੁੱਕ ਹੋਇਆ ਆ ਪਿਛਲੇ ਵਾਰੀ ਖੇਡਾਂ ਹੋਈਆਂ ਬਠਿੰਡੇ ਬਠਿੰਡੇ ਦੇ ਵਿੱਚ ਗੁਰਦਾਸ ਮਾਨ ਜੀ ਦਾ ਸਟ ਸ਼ੋ ਬੁੱਕ ਹੋਇਆ ਬਠਿੰਡਾ ਦਾ ਇੱਕ ਬਹੁਤ ਵਧੀਆ ਸਥਾਨ ਹੈ ਜਿੱਥੇ ਹਾਊਸਫੇਡ ਦੇ ਵਿੱਚ ਟੂਲਿਪ ਆ ਗਿਆ ਔਰ ਸ਼ਹਿਰ ਦੇ ਵੱਡਾ ਖੇਡ ਸਟੇਡੀਅਮ ਹੈ ਉੱਥੇ ਵੱਡੇ ਵੱਡੇ ਗਾਇਕਾਂ ਦੇ ਸਮਾਰੋਹ ਹੁੰਦੇ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲੁਧਿਆਣਾ ਹੈ ਲੁਧਿਆਣੇ ਵਿੱਚ ਸਾਹਿਤ ਸਭਾ ਸਾਹਿਤ ਸਭਾ ਦੇ ਵਿੱਚ ਵੀ ਸਾਹਿਤ ਨਾਲ ਸੰਬੰਧਿਤ ਮਹਿਫ਼ਲਾਂ ਲੱਗਦੀਆਂ ਨੇ ਸ਼ਾਇਰਾਂ ਦੀਆਂ ਮਹਿਫ਼ਲਾਂ ਲੱਗਦੀਆਂ ਨੇ ਸੰਗੀਤ ਨੂੰ ਕਿਸੇ ਵੀ ਰੂਪ ਦੇ ਨਾਲ ਮਾਣਨ ਦੇ ਲਈ ਪੰਜਾਬੀਆਂ ਨੂੰ ਤਾਂ ਬਹਾਨਾ ਚਾਹੀਦਾ ਚਾਹੇ ਉਹ ਉਹਨਾਂ ਦਾ ਵਿਆਹ ਦਾ ਫਕਸ਼ਨ ਹੈ ਤਾਂ ਉਹਨਾਂ ਨੇ ਵਿਆਹ 'ਤੇ ਕਿਸੇ ਪੰਜਾਬੀ ਸਿੰਗਰ ਨੂੰ ਬੁਲਾ ਲੈਣਾ ਜਾਂ ਕਿਤੇ ਕਿਸੇ ਸੋਸਾਇਟੀ ਦਾ ਫਕਸ਼ਨ ਹੈ ਤਾਂ ਉਹਨਾਂ ਨੇ ਸੋਸਾਇਟੀ ਨੂੰ ਹੋਰ ਰੰਗ ਲਾਉਣ ਦੇ ਲਈ ਪੰਜਾਬ ਦੇ ਉੱਘੇ ਗਾਇਕਾਂ ਨੂੰ ਬੁਲਾ ਲੈਣਾ ਟਿਕਟਾਂ ਦਾ ਪਤਾ ਹੀ ਹੈ ਸਰਤਾਜ ਜੀ ਦੇ ਗੱਲ ਕਰ ਲਓ ਚਾਹੇ ਤੁਸੀਂ ਤੁਸੀਂ ਗੱਲ ਕਰੋ ਦਲਜੀਤ ਦੋਸਾਂਝ ਦੀ ਤਾਂ ਬਹੁਤ ਮਹਿੰਗੀਆਂ ਨਹੀਂ ਹੁੰਦੀਆਂ ਕੀਮਤੀਆਂ ਟਿਕ ਟਿਕਟਾਂ ਇਹਨਾਂ ਦੀਆਂ ਮਹਿੰਗੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਪਰ ਆਮ ਲੋਕ ਤਾਂ ਸੰਗੀਤ ਸੁਣਦੇ ਹੀ ਫ਼ੋਨ 'ਤੇ ਆ ਪਰ ਜਿਹੜੇ ਸੰਗੀਤ ਦੇ ਸ਼ੌਕੀਨ ਹੈ ਤਾਂ ਉਹ ਟਿਕਟਾਂ ਖਰੀਦ ਕੇ ਲੈ ਜਾਂਦੇ ਚਾਹੇ ਉਹ ਦੋ ਹਜ਼ਾਰ ਦੀ ਟਿਕਟ ਏ ਚਾਹੇ ਹਜ਼ਾਰ ਦੀ ਚਾਹੇ ਪੰਜ ਸੌ ਦੀ ਉਹਨਾਂ ਨੇ ਉਹ ਸਮਾਰੋਹ ਦੇ ਵਿੱਚ ਸ਼ਾਮਲ ਹੋਣੇ ਹੀ ਹੋਣਾ ਹੁੰਦਾ ਪੰਜਾਬ ਦੇ ਵਿੱਚ ਪਟਿਆਲਾ ਪਟਿਆਲਾ ਸ਼ਾਨ ਹੈ ਪੰਜਾਬ ਦੀ ਰਾਜਿਆਂ ਦਾ ਸ਼ਹਿਰ ਹੈ ਉੱਥੇ ਵੀ ਇੱਕ ਦੋ ਸਮਾਰੋਹ ਸਥਾਨ ਹੈ ਜਿੱਥੇ ਸੰਗੀਤ ਦੀਆਂ ਮਹਿਫ਼ਲਾਂ ਸਾਲ 'ਚ ਇੱਕ ਦੋ ਵਾਰੀ ਲੱਗਦੀਆਂ ਰਹਿੰਦੀਆਂ ਨੇ ਬਸ ਪੰਜਾਬ ਦੇ ਵਿੱਚ ਸੰਗੀਤ ਲੱਭਣਾ ਨਹੀਂ ਪੈਂਦਾ ਹਰ ਜਗ੍ਹਾ ਮਿਲ ਜਾਂਦਾ